ਸਤਿ ਸ਼੍ਰੀ ਅਕਾਲ ਜੀ ਮੈਂ ਹੁਸ਼ਿਆਰਪੁਰ ਦੇ ਵਿੱਚ ਫੂਡ ਵਲੋਗਰ ਹਾਂ ਅਤੇ ਮੈਂ ਤੁਹਾਡੇ ਤੋਂ ਪੁੱਛਣਾ ਸੀਗਾ ਕਿ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਫੇਮਸ ਚੀਜ਼ਾਂ ਕਿਹੜੀਆਂ ਖਾਣ ਵਾਲੀਆਂ ਇਹ ਤੁਸੀਂ ਦੱਸ ਸਕਦੇ ਹੋ ਠੀਕ ਹੈ ਜੀ ਅੱਛਾ ਜੀ

ਹੁਸ਼ਿਆਰਪੁਰ ਦੇ ਵਿੱਚ ਜੇ ਮੈਂ ਕਿਸੇ ਵਧੀਆ ਰੈਸਟੋਰੈਂਟ 'ਚ ਜਾਣਾ ਹੋਵੇ ਜਿੱਥੇ ਹੈਲਦੀ ਫੂਡ ਵੀ ਮਿਲ ਸਕੇ ਕੀ ਤੁਸੀਂ ਮੈਨੂੰ ਰਿਕੋਮੈਂਡ ਕਰ ਸਕਦੇ ਹੋ ਕਿੱਥੇ ਜਾਣਾ ਚਾਹੀਦਾ ਮੈਨੂੰ

ਅੱਛਾ ਜੀ ਅੱਛਾ ਜੀ ਅਤੇ ਮੈਂ ਇੱਕ ਸੁਣਿਆ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਜਗ੍ਹਾ ਹੈ ਜਿੱਥੇ ਸਟ੍ਰੀਟ ਫੂਡ ਮਿਲ ਮਿਲਦਾ ਆ ਬਟ ਉੱਥੇ ਰੇਹੜੀਆਂ ਰਾਤ ਨੂੰ ਲੱਗਦੀਆਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਜੇ ਉੱਥੇ ਜਾਣਾ ਹੋਵੇ ਤਾਂ ਉਹ ਕਿੱਥੇ ਪੈਂਦਾ ਹੈ ਅੱਛਾ ਜੀ ਠੀਕ ਹੈ ਜੀ ਓਕੇ ਜੀ ਅਤੇ ਇੱਥੇ ਰੇਟ ਵਗੈਰਾ ਸਹੀ ਹੁੰਦਾ ਹੈ ਠੀਕ ਹੈ ਜੀ ਮੈਂ ਜ਼ਰੂਰ ਟਰਾਈ ਕਰੂੰਗੀ ਜੋ ਜੋ ਤੁਸੀਂ ਮੈਨੂੰ ਸਜੈਸਟ ਕੀਤਾ ਆ ਅਤੇ ਮੈਂ ਇਸਨੂੰ ਆਪਣੀ ਇੰਸਟਾਗਰਾਮ 'ਤੇ ਪੋਸਟ ਜ਼ਰੂਰ ਕਰੂੰਗੀ ਤੁਸੀਂ ਮੇਰੀ ਆਈ ਡੀ ਚੈੱਕ ਕਰ ਲਿਓ ਗਾਇਤਰੀ ਫੂਡ ਬਲੋਗਰ ਹਾਂਜੀ ਧੰਨਵਾਦ ਜੀ ਓਕੇ